ਜਿਹੜੇ ਸਾਡੀ ਵੀ ਆਪਣੀ ਇਲਾਕੇ ਦੇ ਜਾਂ ਪਿੰਡ ਦੇ ਲੋਕ ਨਾਚ ਹੈਗੇ ਸਾਡੀ ਇਹ ਹੀ ਇੱਛਾ ਕਿ ਉਹਨਾਂ ਨੂੰ ਅੱਗੇ ਪੀੜ੍ਹੀ ਦਰ ਪੀੜ੍ਹੀ ਵਧਾਇਆ ਜਾਵੇ ਅਤੇ ਉਹਨਾਂ ਨੂੰ ਜਿਵੇਂ ਪਿੱਛੋਂ ਕੈਮਾ ਰੇ ਹੈਗੇ ਥੋੜ੍ਹਾ ਜਿਹਾ ਹੁਣ ਇਸ ਟਾਈਮ 'ਚ ਬਦਲਾਅ ਆ ਗਿਆ ਕਿ ਲੋਕ ਨਾਚ ਦੀ ਜਗ੍ਹਾ ਗਿੱਧੇ ਭੰਗੜੇ ਦੀ ਜਗ੍ਹਾ ਸਾਡੇ ਲੋਕ ਨਾਚ ਗਿੱਧਾ ਅਤੇ ਭੰਗੜਾ ਨਹੀਂ ਇਹਨਾਂ ਦੀ ਜਗ੍ਹਾ ਡੀਜਿਆ ਨੇ ਲੈ ਲਈ ਅਤੇ ਲੋਕ ਡੀਜਿਆ 'ਤੇ ਹੀ ਨੱਚਦੇ ਹੈ ਪਰ ਸਾਡੀ ਇੱਛਾ ਹੈ ਕਿ ਡੀਜਿਆਂ ਦੀ ਜਗ੍ਹਾ 'ਤੇ ਸਾਡਾ ਮੇਨ ਜਿਹੜਾ ਸੱਭਿਆਚਾਰ ਨਾਲ ਰਿਲੇਟਡ ਹੈਗਾ ਸਾਜ ਢੋਲ ਢੋਲ ਦੀ ਅਤੇ ਬਾਜਿਆਂ ਦੀ ਵਰਤੋਂ ਕੀਤੀ ਜਾਵੇ ਅਤੇ ਢੋਲ ਦੇ ਉੱਪਰ ਬੋਲੀਆਂ ਪਾਈਆਂ ਜਾਣ ਗਿੱਧਾ ਪਾਇਆ ਜਾਵੇ ਭੰਗੜਾ ਪਾਇਆ ਜਾਵੇ ਅਤੇ ਬਾਜਿਆਂ ਦੇ ਨਾਲ ਹੀ ਉਸਦਾ ਨਾਚ ਕੀਤਾ ਜਾਵੇ ਅਤੇ ਡੀਜਿਆ ਨਾਲ ਨਾਲੇ ਤਾਂ ਪ੍ਰਦੂਸ਼ਣ ਹੁੰਦਾ ਗਾ ਇਹ ਜ਼ਿਆਦਾ ਜ ਜ਼ਿਆਦਾ ਸ਼ੋਰ ਕਰਦੇ ਹੈਗੇ ਅਤੇ ਡੀ ਜੇ ਜਿਹੜਾ ਇਹ ਹੈ ਸਾਡੇ ਸੱਭਿਆਚਾਰ ਨਾਲ ਰਿਲੇਟਡ ਨਹੀਂ ਹੈਗੇ ਕਿ ਅਤੇ ਸਾਡੀ ਇੱਛਾ ਕਿ ਸਾਡੇ ਲੋਕ ਨਾਚਾਂ ਨੂੰ ਕਾਇਮ ਰੱਖਿਆ ਜਾਵੇ ਸਾਡੀ ਇਹ ਵੀ ਇੱਛਾ ਕਿ ਇਹਨਾਂ ਨੂੰ ਸੁਰੱਖਿਤ ਸੁਧਾਰ ਤਾਂ ਸਿਰਫ਼ ਇਹ ਹੀ ਹੈ ਕਿ ਇਹਨਾਂ ਨੂੰ ਅਗਲੀ ਪੀੜ੍ਹੀ ਵਿੱਚ ਵੀ ਕਾਇਮ ਰੱਖਿਆ ਜਾਵੇ ਵੀ ਪੀੜ੍ਹੀਆਂ ਇਹਨਾਂ ਨੂੰ ਜਿਹੜੀ ਆਉਣ ਵਾਲੀ ਪੀੜ੍ਹੀ ਆ ਸਾਡੇ ਟਾਈਮ ਦੀ ਇਹ ਵੀ ਇਹਨਾਂ ਨੂੰ ਕਾਇਮ ਰੱਖ ਸਕੇ ਇਹ ਵੀ ਢੋਲ ਦੇ ਉੱਪਰ ਬਾਜਿਆਂ ਦੇ ਉੱਪਰ ਗਿੱਧਾ ਭੰਗੜਾ ਪਾਉਣ ਅਤੇ ਵੱਧ ਤੋਂ ਵੱਧ ਬੋਲੀਆਂ ਪਾਉਣ ਤਾਂ ਕਿ ਆਉਣ ਵਾਲੇ ਸਮਾਂ ਬੱਚਿਆਂ ਨੂੰ ਵੀ ਸਾਡੇ ਸੱਭਿਆਚਾਰ ਬਾਰੇ ਪਤਾ ਲੱਗ ਸਕੇ ਕਿ ਸਾਡਾ ਕਲਚਰ ਕਿਸ ਤਰ੍ਹਾਂ ਦਾ ਸੀ ਅਤੇ ਇਹਦੇ ਨਾਲ ਆਪਣੇ ਮਨ ਦੇ ਹਾਵ ਭਾਵ ਵੀ ਪੈਦਾ ਹੁੰਦੇ ਹੈ ਕਿ ਜਦੋਂ ਆਪਾਂ ਆਪਣੇ ਬੋਲੀਆਂ ਪਾਉਦੇ ਹਾਂ ਜਾਂ ਭੰਗੜਾ ਪਾਉਦੇ ਆਗੇ ਨਾਲੇ ਸਾਡੀ ਇੱਕ ਤਰ੍ਹਾਂ ਦੀ ਐਕਸਰਸਾਈਜ਼ ਵੀ ਹੋ ਜਾਂਦੀ ਹੈਗੀ ਜੁਬਾਨ ਦੀ ਵੀ ਅਤੇ ਆਪਣੀ ਸਰੀਰ ਦੀ ਵੀ ਐਕਸਰਸਾਈਜ਼ ਹੁੰਦੀ ਹੈਗੀ ਅਤੇ ਨਾਲੇ ਆਪਣਾ ਜਿਹੜਾ ਉਹ ਸੱਭਿਆਚਾਰ ਅੱਗੇ ਵੱਧਦਾ ਹੈਗਾ ਅਤੇ ਇਹਨੂੰ ਅੱਗੇ ਵਧਾਇਆ ਜਾਵੇ ਅਤੇ ਇਹਨੂੰ ਵਧੀਆ ਤੋਂ ਵਧੀਆ ਕੀਤਾ ਜਾਵੇ ਅਤੇ ਇਹ ਹੀ ਇੱਛਾ